ਹਾਂਜੀ ਹਾਂ ਰੂਪਾ ਹਾਂਜੀ ਹਾਂਜੀ ਪਲੱਸ ਟੂ ਕੀਤੀ ਹੋਈ ਹੈ ਜੀ ਤੁਸੀਂ ਠੀਕ ਹੈ ਜੀ ਅਤੇ ਹੁਣ ਤੁਸੀਂ ਕਿੱਥੇ ਲੱਗਣਾ ਚਾਹੁੰਦੇ ਹੋ ਮਤਲਬ ਕਿ ਮਾਨਸਾ ਲੱਗਣਾ ਚਾਹੁੰਦੇ ਹੋ ਹਾਂਜੀ ਹੈਗਾ ਹੈ ਡਾਇਮੰਡ ਕੋਚਿੰਗ ਸੈਂਟਰ ਤਿੰਨ ਕੋਨੀ ਕੋਲ ਮੈਂ ਉੱਥੇ ਕੋਚਿੰਗ ਕੀਤੀ ਹੋਈ ਹੈ ਜੀ ਹਾਂਜੀ ਪਹਿਲਾਂ ਕੀਤੀ ਸੀ ਜੀ ਵਧੀਆ ਉੱਥੇ ਨੌਕਰੀ ਵੀ ਦਿੰਦੇ ਨੇ ਕੋਚਿੰਗ ਕਰਨ ਤੋਂ ਬਾਅਦ ਨੌਕਰੀ ਦਾ ਪੂਰਾ ਪੱਕਾ ਗਾ ਵੀ ਨੌਕਰੀ ਮਿਲ ਸਕਦੀ ਆ ਤੁਹਾਨੂੰ ਬੱਚੇ ਬਹੁਤ ਵਾਧੂ ਬੱਚੇ ਹੁੰਦੇ ਨੇਗੇ ਮੈਡਮ ਦਾ ਸੁਭਾਅ ਬਹੁਤ ਵਧੀਆ ਗਾ ਅਤੇ ਉੱਥੇ ਵਧੀਆ ਸਾਰੇ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹੈਗੇ ਜਵਾਕਾਂ ਵਾਂਗੂ ਜਾਂ ਆਪਸ ਵਿੱਚ ਆਪਾਂ ਫਰੈਂਡਸ ਗੱਲ ਕਰਦੇ ਹੁੰਦੇ ਹਾਂ ਉਵੇਂ ਵਧੀਆ ਗੱਲ ਕਰਦੇ ਨੇਗੇ ਅਤੇ ਉੱਥੇ ਸਫ਼ਾਈ ਸਫੂਈ ਦਾ ਵਧੀਆ ਪ੍ਰਬੰਧ ਹੈਗਾ ਹੈ ਨਾ ਪੂਰਾ ਵਧੀਆ ਗਾ ਕੋਈ ਐਂਵੇਂ ਦੀ ਗੱਲ ਨਹੀਂ ਹੈਗੀ ਸਾਰਾ ਕੁਝ ਬਹੁਤ ਵਧੀਆ ਗਾ ਟੀਚਰ ਨਾਲ ਕੋਈ ਡਰਨ ਦੀ ਗੱਲ ਨਹੀਂ ਆਪਣੇ ਆਪਸ ਵਾਂਗੂ ਜਿਵੇਂ ਆਪਾਂ ਗੱਲ ਕਰਦੇ ਹਾਂ ਉਵੇਂ ਕਰਦੇ ਨੇ ਵਧੀਆ ਮੈਂ ਲਗਾਏ ਸੀ ਪੰਜ ਸਾਲ ਹਾਂਜੀ ਕਲੀਅਰ ਹੋ ਗਿਆ ਮੈਂ ਦੋ ਤਿੰਨ ਕੋਰਸ ਕੀਤੇ ਤੇ ਨਾ ਫਿਰ ਜੋਬ ਵੀ ਮਿਲ ਸਕਦੀ ਹੈ ਇਹਦੇ ਨਾਲ ਜੋਬ ਵੀ ਕੀਤੀ ਹੋਈ ਉੱਥੇ ਮੈਂ ਇੱਕ ਵਾਰ ਹੋਰ ਜੀ ਤੁਸੀਂ ਪਹਿਲਾਂ ਕਿਤੇ ਕੀਤੀ ਹੈ ਪੜ੍ਹਾਈ ਕੀਤਾ ਨਹੀਂ ਕਿਤੇ ਵੀ ਕੋਰਸ ਫੀਸ ਜੀ ਪੰਦਰਾਂ ਹਜ਼ਾਰ ਤੱਕ ਆ ਪੰਦਰਾਂ ਵੀਹ ਤੱਕ ਆ ਬੇਸਿਕ ਸਿੱਖਣ ਦਾ ਪੰਦਰਾਂ ਕੁ ਹਜ਼ਾਰ ਆ ਹਾਂ ਉਹ ਦੇਖ ਲਾਂਗੇ ਘੱਟ ਕਰ ਦੇਣਗੇ ਗੱਲ ਕਰ ਲਾਂਗੇ ਹਾਂਜੀ ਅਤੇ ਜਾਣ ਦਾ ਤੁਹਾਨੂੰ ਪਤਾ ਗਾ ਕਿੱਥੇ ਹੈ ਇਹ ਵੀ ਇਹ ਡਾਇਮੰਡ ਕੋਚਿੰਗ ਸੈਂਟਰ ਤੁਹਾਨੂੰ ਪਤਾ ਕਿੱਥੇ ਹੈਗੀ ਹੈ ਕੋਈ ਨਾ ਤੁਸੀਂ ਅੱਗੇ ਮਿਲ ਜਾਇਓ ਉੱਥੇ ਮਾਨਸਾ ਅੱਡੇ ਕੋਲ ਤਿੰਨ ਕੋ ਉਹ ਮਾਨਸਾ ਅੱਡੇ ਤੋਂ ਤਿੰਨ ਕੋਨੀ ਵਾਲੀ ਬੱਸ ਚੜ੍ਹਨੀ ਹੈਗੀ ਉੱਥੇ ਆਪਾਂ ਮਿਲ ਜਾਂਗੇ ਮੈਂ ਤੁਹਾਡੇ ਨਾਲ ਵੱਗ ਜੂੰਗੀਂ ਠੀਕ ਹੈ ਜੀ ਅਤੇ ਮੇਰੀ ਜਾਣ ਪਛਾਣ ਹੈਗੀ ਹੈ ਫੀਸ ਆਪਾਂ ਘੱਟ ਵੱਧ ਕਰ ਲਾਂਗੇ ਠੀਕ ਹੈ ਜੀ ਹਾਂਜੀ ਅਤੇ ਨਾ ਉੱਥੇ ਮਹੌਲ ਬਹੁਤ ਵਧੀਆ ਗਾ ਟੀਚਰਸ ਵੀ ਬਹੁਤ ਵਧੀਆ ਨੇਗੇ ਅਤੇ ਸਟੂਡੈਂਟ ਵੀ ਬਹੁਤ ਵਧੀਆ ਨੇ ਆਪਣੇ ਮਿਲ ਵਰਤਣ ਜਿਹੇ ਵਾਲੇ ਆ ਵਧੀਆ ਮਿਲ ਜੁਲ ਕੇ ਰਹਿੰਦੇ ਨੇ ਹੋਰ ਉੱਥੇ ਵਾਧੂ ਲੱਗੇ ਹੋਏ ਨੇ ਟੀਚ ਸਟੂਡੈਂਟਸ ਬਹੁਤ ਸਿੱਖਣ ਆਉਂਦੇ ਨੇ ਉੱਥੇ ਹਾਂਜੀ ਕੱਲ੍ਹ ਤੋਂ ਆ ਜਾਇਓ ਆ ਜਾਇਓ ਆਪਾਂ ਵਗ ਜਾਂਗੇ ਤੁਹਾਡਾ ਅਡਮੀਸ਼ਨ ਕਰਾਉਣਾ ਜੀ ਉੱਥੇ ਠੀਕ ਹੈ ਜੀ